ਡਾਂਸ ਦਾ ਹੁਨਰ ਪੰਜਾਬੀਆਂ ਵਿੱਚ ਹੁਨਰ ਤਾਂ ਬਹੁਤ ਨੇ ਜਿਵੇਂ ਕਿ ਨੱਚਣਾ ਟੱਪਣਾ ਭੰਗੜੇ ਪਾਉਣਾ ਬੋਲੀਆਂ ਪਾਉਣਾ ਪਰ ਉਹਨਾਂ ਨੂੰ ਇਹ ਪ੍ਰੇਰਨਾ ਉਹਨਾਂ ਦੀ ਖੁਸ਼ੀ ਤੋਂ ਮਿਲਦੀ ਹੈ ਉਹ ਆਪਣੀ ਖੁਸ਼ੀ ਨੂੰ ਪ੍ਰਗਟ ਕਰਨ ਲਈ ਨੱਚਦੇ ਟੱਪਦੇ ਨੇ ਭੰਗੜੇ ਪਾਉਂਦੇ ਨੇ ਖੁਸ਼ੀ ਮਨਾਉਂਦੇ ਨੇ ਉਹਨਾਂ ਦਾ ਹੁਨਰ ਹੀ ਉਹਨਾਂ ਦੀ ਖੁਸ਼ੀ ਹੈ ਪੰਜਾਬੀ ਇੱਕ ਦੂਸਰੇ ਤੋਂ ਸਿੱਖ ਕੇ ਆਪਣੇ ਡਾਂਸ ਦੇ ਵਿੱਚ ਸੁਧਾਰ ਲਿਆਉਂਦੇ ਨੇ ਜਿਵੇਂ ਕਿ ਕਿਸੇ ਨੂੰ ਖੁਸ਼ੀ ਮਨਾਉਂਦੇ ਦੇਖ ਕੇ ਕੋਈ ਨੱਚ ਰਿਹਾ ਕੋਈ ਟੱਪ ਰਿਹਾ ਉਹਨਾਂ ਨੂੰ ਦੇਖ ਦੇਖ ਕੇ ਉਹ ਆਪਣੇ ਹੁਨਰ ਨੂੰ ਵਧਾਉਂਦੇ ਨੇ ਜਿਵੇਂ ਕਿ ਮੈਂ ਵੀ ਆਪਣੇ ਡਾਂਸ ਨੂੰ ਆਪਣੇ ਭੰਗੜੇ ਨੂੰ ਜੋ ਕਿ ਮੈਨੂੰ ਬਹੁਤ ਪਿਆਰਾ ਲੱਗਦਾ ਬਹੁਤ ਹੀ ਸਤਿਕਾਰਯੋਗ ਸਾਡੇ ਵੱਡੇ ਭਰਾ ਜਿਹਨਾਂ ਤੋਂ ਮੈਂ ਇਹ ਹੁਨਰ ਪ੍ਰਾਪਤ ਕੀਤਾ ਹੈ